ਨਾਗਰਿਕਾਂ ਦੀ ਸੁਰਕਸ਼ਾ ਇੱਕ ਅਹਿਮ ਮੁੱਦਾ ਹੈ ਅਗਰ ਕਿਸੇ ਦੇਸ਼ ਦੇ ਨਾਗਰਿਕ ਹੀ ਸੁਰਕਸ਼ਿਤ ਨਹੀਂ ਹੋਣਗੇ ਤਾਂ ਦੇਸ਼ ਦੀ ਤਰੱਕੀ ਵੱਲ ਕਿਵੇਂ ਜਾਏਗਾ ਇਸ ਕਰਕੇ ਸਾਡੀ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਨਾਗਰਿਕਾਂ ਨੂੰ ਸੁਰਕਸ਼ਿਤ ਰੱਖੇ ਜਿਵੇਂ ਜਿਵੇਂ ਕਿ ਅਪਰਾਧ ਵਧਦੇ ਜਾ ਰਹੇ ਆ ਆਪਾਂ ਸਾਰੇ ਵੇਖਣ ਡੇ ਹਾਂ ਕਿ ਦਿਨ ਬ ਦਿਨ ਵਧਦੇ ਅਪ ਅਪ ਅਪਰਾਧ ਹੋਈ ਜਾ ਰਹੇ ਹੈ ਜਿੱਦਾਂ ਕਿ ਕੁੜੀਆਂ ਆਪਣੇ ਜਦੋਂ ਬਾਹਰ ਜਾਂਦੀ ਹੈ ਉਹ ਸੁਰਕਸ਼ਿਤ ਹੈ ਨਹੀਂ ਹੈ ਇਸ ਕਰਕੇ ਸਾਡੀ ਜਿਹੜੀ ਸਰਕਾਰ ਹੈ ਉਹਨੂੰ ਕੜੇ ਤੋਂ ਕੜੇ ਕਦਮ ਉਠਾਉਣੇ ਚਾਹੀਦੇ ਹੈ ਜਿਸ ਕਾਰਨ ਹਰ ਇੱਕ ਨਾਗਰਿਕ ਆਪਣੇ ਆਪ ਨੂੰ ਸੁ ਸੁਰਕਸ਼ਿਤ ਸੁਰਕਸ਼ਿਤ ਰ ਰੱਖੇ ਅਤੇ ਬਾਕੀਆਂ ਨੂੰ ਵੀ ਇਹ ਸਲਾਹ ਦੇ ਕਿ ਤੁਸੀਂ ਗਲਤ ਕੰਮ ਨਾ ਕਰੋ ਇਸ ਕਰਕੇ ਜਿਹੜਾ ਕੋਈ ਗਲਤ ਕੰਮ ਕਰਦਾ ਹੈ ਉਹਦੇ ਲਈ ਕੜੇ ਤੋਂ ਕੜੇ ਦੰਡ ਰੱਖਣਾ ਚਾਹੀਦਾ ਜਿਹਦੇ ਕਾਰਨ ਲੋਕ ਲੋਕ ਕੋਈ ਵੀ ਗਲਤੀ ਕਰਨ ਤੋਂ ਪਹਿਲਾਂ ਸੌ ਵਾਰੀ ਸੋਤੇ ਸੋਚੇ ਜਿੱਦਾਂ ਕਿ ਕੋਈ ਟਰੈਫਿਕ ਸਿਗਨਲ ਲੰਘ ਕੇ ਜਾਂਦਾ ਹੈ ਉਹਦੇ ਲਈ ਜੁਰਮਾਨਾ ਰੱਖਣਾ ਚਾਹੀਦਾ ਇੰਨਾਂ ਜੁਰਮਾਨਾ ਕਿ ਅਗਲਾ ਬੰਦਾ ਸੌ ਵਾਰੀ ਟਰੈਫਿਕ ਸਿਗਨਲ ਸੋ ਤੋੜਨ ਤੋਂ ਪਹਿਲਾਂ ਸੋਚੇ ਕਿ ਮੈਂ ਟਰੈਫਿਕ ਸਿਗਨਲ ਸੋ ਤੋੜਨ ਦੀ ਗਲਤੀ ਕਿਉਂ ਕੀਤੀ ਸੀਗੀ